ਹੈਲੋ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਮੈਂ ਤੁਹਾਡੇ ਉਹ ਹੋਟਲ ਰੂਮ ਨੰਬਰ ਵਨ ਜ਼ੀਰੋ ਵਨ ਤੋਂ ਬੋਲ ਰਹੀ ਹਾਂ ਮੈਮ ਲੰਚ ਦਾ ਔਡਰ ਕਰਨਾ ਸੀਗਾ ਇੱਕ ਦਾਲ ਮੱਖਣੀ ਕਰ ਦਿਓ ਅਤੇ ਇੱਕ ਪਨੀਰ ਬਟਰ ਮਸਾਲਾ ਦੋ ਤੰਦੂਰੀ ਨਾਨ ਹਾਂਜੀ ਅਤੇ ਇਹਦੇ ਚਾਰਜਿਸ ਕੀ ਆ ਪੇਮੈਂਟ ਦੱਸ ਦਿਓ ਓਕੇ ਮੈਮ ਓਕੇ ਠੀਕ ਹੈ ਜੀ ਓਕੇ ਸ਼ੁਕਰੀਆ